ਹੈਲੋ ਭਾਅ ਜੀ ਮੀਸ਼ੋ ਤੋਂ ਬੋਲ ਰਹੇ ਜੇ ਭਾਅ ਜੀ ਮੈਂ ਦੋ ਨਾ ਆਡਰ ਬੁੱਕ ਕੀਤੇ ਸੀ ਤੁਹਾਡੇ ਕੋਲੋਂ ਇੱਕ ਸੀ ਜੁੱਤੀ ਅਤੇ ਇੱਕ ਸੀ ਸਵੈਟਰ ਜੁੱਤੀ ਜਿਹੜੀ ਉਹ ਤਾਂ ਬਹੁਤ ਵਧੀਆ ਨਿਕਲੀ ਆ ਪਰ ਜਿਹੜਾ ਸਵੈਟਰ ਆ ਉਹਦੇ ਬਾਰੇ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਜਿਹੜਾ ਤੁਸੀਂ ਆਪਣੇ ਪੇਜ 'ਤੇ ਫੋਟੋ ਪਾਈ ਆ ਉਹ ਵੇਖਣ ਨੂੰ ਤਾਂ ਬਹੁਤ ਵਧੀਆ ਲੱਗਦੀ ਆ ਅਤੇ ਉਹ ਫੋਟੋ ਵੇਖ ਕੇ ਹੀ ਮੈਂ ਜਿਹੜਾ ਇਹ ਆਡਰ ਸਵੈਟਰ ਦਾ ਤੁਹਾਨੂੰ ਦਿੱਤਾ ਸੀ ਭਾਅ ਜੀ ਇੱਕ ਤਾਂ ਇਹ ਮੇਰੇ ਨਾਪ ਦਾ ਨਹੀਂ ਆਇਆ ਖੁੱਲ੍ਹਾ ਆ ਗਿਆ ਵਾ ਦੂਜਾ ਜਿਹੜਾ ਰੰਗ ਤੁਸੀਂ ਉਸ ਫੋਟੋ 'ਤੇ ਦਿੱਤਾ ਸੀ ਉਹ ਰੰਗ ਵੀ ਨਹੀਂ ਆ ਪੂਰਾ ਫਿਰ ਦੂਜੀ ਗੱਲ ਇਹ ਕਿ ਮੈਂ ਜਦੋਂ ਇਹਨੂੰ ਧੋਤਾ ਤਾਂ ਇਹ ਹੋਰ ਹੀ ਢਿੱਲਾ ਜਿਹਾ ਹੋ ਗਿਆ ਬਿਲਕੁਲ ਹੀ ਵੇਖਣ ਨੂੰ ਹੁਣ ਸੋਹਣਾ ਨਹੀਂ ਲੱਗ ਰਿਹਾ ਸਾਰਾ ਹੀ ਲੂੰਈਂ ਦੇ ਨਾਲ ਭਰ ਚੁੱਕਾ ਵਾ ਭਾਅ ਜੀ ਜੋ ਆਪਣੇ ਪੇਜ 'ਤੇ ਪਾਉਂਦੇ ਹੁੰਦੇ ਜੇ ਉਹ ਹੀ ਚੀਜ਼ ਅਗਲੇ ਨੂੰ ਭੇਜਿਆ ਕਰੋ ਜਾਂ ਤਾਂ ਫਿਰ ਇੱਦਾਂ ਦੀਆਂ ਚੀਜ਼ਾਂ ਨਾ ਭੇਜਿਆ ਕਰੋ ਵਿਖਾਇਆ ਹੀ ਨਾ ਕਰੋ ਜੋ ਤੁਸੀਂ ਪਾਈਆਂ ਹੁੰਦੀਆਂ ਤੁੰਬ ਵੀ ਭਾਅ ਜੀ ਉਹਨੂੰ ਲੱਗੀ ਹੋਈ ਜੇ ਸੋ ਵੇਖਣ ਨੂੰ ਬੜਾ ਹੀ ਜ਼ਿਆਦਾ ਨਾ ਬੁਰਾ ਜਿਹਾ ਲੱਗ ਰਿਹਾ ਵਾ ਪੈਸੇ ਵੀ ਤੁਸੀਂ ਪੂਰੇ ਲਗਾਉਂਦੇ ਜੇ ਅਤੇ ਚੀਜ਼ ਵੀ ਤੁਸੀਂ ਘਟੀਆ ਦਿੰਦੇ ਜੇ ਅੱਗੇ ਤੋਂ ਭਾਅ ਜੀ ਆਪਣੀਆਂ ਜਿਹੜੀਆਂ ਚੀਜ਼ਾਂ ਵਾ ਨਾ ਵਧੀਆ ਭੇਜਿਆ ਕਰੋ